ਹਾਂ ਸਾਡੇ ਖੇਤਰ ਦੇ ਵਿੱਚ ਇਤਿਹਾਸਿਕ ਮੱਤ ਵਾਲੇ ਨਿਸ਼ਾਨ ਬਹੁਤ ਜ਼ਿਆਦਾ ਨੇ ਜਿਹਨਾਂ ਵਿੱਚੋਂ ਮੇਨ ਮਹੱਤਵਪੂਰਨ ਨਿਸ਼ਾਨ ਕਹਿ ਲਈਏ ਆਪਾਂ ਤਾਂ ਆਪਣਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਬਣਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਉਨਾਂ ਦੇ ਚਾਰ ਪੁੱਤਰ ਦੇ ਵਿੱਚੋਂ ਦੋ ਪੁੱਤਰ ਜੋ ਛੋਟੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦ ਹੋਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਆਪਣਾ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜੋ ਸਰਹੰਦ ਸੀ ਉੱਥੇ ਇੱਟ ਨਾਲ਼ ਇੱਟ ਖੜਕਾਈ ਇਸ ਕਰਕੇ ਇੱਥੇ ਹੋਰ ਵੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਟੋਡਰ ਮੱਲ ਦੀ ਹਵੇਲੀ ਮੋਤੀ ਰਾਮ ਮਹਿਰਾ ਜੀ ਦਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੋਰ ਵੀ ਬਹੁਤ ਜ਼ਿਆਦਾ ਗੁਰੂ ਘਰ ਨਾਲ ਸੰਬੰਧਿਤ ਇੱਥੇ ਗੁਰੂ ਘਰ ਸਥਿਤ ਨੇ ਜੋ ਕਿ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ